ਮੋਹਾਲੀ ਜ਼ਿਲ੍ਹੇ ਵਿੱਚ ਬਹੁਤ ਸਾਰੇ ਇਹ ਜੇ ਅਜਿਹੇ ਮਹੱਤਵਪੂਰਨ ਸਥਾਨ ਅਤੇ ਇਤਿਹਾਸਿਕ ਅਸਥਾਨ ਹਨ ਜਿਵੇਂ ਕਿ ਮੋਹਾਲੀ ਜ਼ਿਲ੍ਹੇ ਦੇ ਇਤਿਹਾਸਿਕ ਗੁਰੂ ਘਰ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ ਸੋਹਾਣਾ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਅਤੇ ਮੰਦਰਾਂ ਦੇ ਵਿੱਚੋਂ ਭੈਰੋਂ ਮੰਦਰ ਸਿਸਮਾ ਸ਼ਿਵ ਨਰਾਇਣ ਮੰਦਿਰ ਸੈਕਟਰ ਸਤਾਰ੍ਹਾਂ ਮੋਹਾਲੀ ਬਾਬਾ ਬੰਦਾ ਸਿੰਘ ਬਹਾਦਰ ਬੁਰਜ ਚੱਪੜਚਿੜੀ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜੰਗ ਲੜਿਆ ਸੀ ਅਤੇ ਕੁਝ ਅਜਿਹੇ ਜਿਹੜੇ ਸਥਾਨ ਨੇ ਜਿੱਥੇ ਲੋਕ ਆਮ ਘੁੰਮਣ ਦੇ ਲਈ ਜਾਂਦੇ ਨੇ ਜਿਹੜਾ ਆਪਣਾ ਸਮਾਂ ਬਤੀਤ ਕਰਨ ਜਾਂਦੇ ਨੇ ਜਿਵੇਂ ਕਿ ਸਿਸਮਾ ਡੈਮ ਹੋ ਗਿਆ ਸੁਖਨਾ ਝੀਲ ਵੀ ਆਰ ਮੋਲ ਅਤੇ ਹੋਰ ਵੀ ਇਸ ਜ਼ਿਲ੍ਹੇ ਅੰਦ ਜ਼ਿਲ੍ਹੇ ਦੇ ਅੰਦਰ ਬਹੁਤ ਸਾਰੇ ਸਥਾਨ ਹਨ ਜਿੱਥੇ ਲੋਕ ਆਪਣਾ ਖਾਲੀ ਸਮਾਂ ਬਤੀਤ ਕਰਨ ਜਾਂਦੇ ਹਨ